ਗੱਲ ਇਹ ਹੈ ਕਿ ਖਾਣਾ ਬਣਾਉਣਾ ਮੇਰਾ ਸ਼ੌਂਕ ਹੈ ਮੈਂ ਇਸਨੂੰ ਪੇਸ਼ਾ ਨਹੀਂ ਬਣਾਉਣਾ ਚਾਹੁੰਦੀ ਮੇਰਾ ਖਾਣਾ ਬਣਾਉਣਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਮੈਂ ਹਰ ਰੋਜ਼ ਮੇ ਮੇਰਾ ਮੈਂ ਹਰ ਰੋਜ਼ ਹੀ ਆਪਣੇ ਘਰ ਘਰਦਿਆਂ ਨੂੰ ਨਵੀਂ ਨਵੀਂ ਚੀਜ਼ਾਂ ਬਣਾ ਕੇ ਖਿਲਾਉਣ ਦਾ ਮੈਨੂੰ ਬਹੁਤ ਸ਼ੌਂਕ ਹੈ ਅਤੇ ਖੁਦ ਵੀ ਖਾਣ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਯੂਟਿਊਬ 'ਤੇ ਨਵੇਂ ਨਵੇਂ ਯੂਟਿਊਬਰਾਂ ਦੀ ਵੀਡੀਓਜ਼ ਦੇਖ ਕੇ ਨਵੀਂ ਨਵੀਂ ਚੀਜ਼ਾਂ ਬਣਾਉਣਾ ਸਿੱਖਦੀ ਹਾਂ ਅਤੇ ਆਪਣੇ ਘਰਦਿਆਂ ਨੂੰ ਵੀ ਖਿਲਾਉਂਦੀ ਹਾਂ ਅਤੇ ਮੈਂ ਇਹ ਆਪਣਾ ਖਾਣਾ ਬਣਾਉਣ ਦੇ ਸ਼ੌਂਕ ਨੂੰ ਪੇਸ਼ੇ ਵਜੋਂ ਨਹੀਂ ਬਣਾਉਣਾ ਚਾਹੁੰਦੀ